ਹੈਲੋ ਹਾਂਜੀ ਹਾਂਜੀ ਹਾਂਜੀ ਫੋਨ ਦੀ ਦੁਕਾਨਾਂ ਤੋਂ ਬੋਲਦੇ ਹਾਂ ਜੀ ਹਾਂਜੀ ਸਾਰੀਆਂ ਕੰਪਨੀਆਂ ਦੇ ਫੋਨ ਮਿਲ ਜਾਣਗੇ ਨਵੇਂ ਵੀ ਹੈਗੇ ਨੇ ਪੁਰਾਣੇ ਵੀ ਹੈਗੇ ਨੇ ਦੱਸੋ ਜੀ ਕਿਹੜੀ ਕੰਪਨੀ ਦਾ ਫੋਨ ਚਾਹੀਦਾ ਤੁਹਾਨੂੰ ਅੱਛਾ ਜੀ ਵਨ ਪਲੱਸ ਦੇ ਸਾਡੇ ਕੋਲ ਤਿੰਨ ਚਾਰ ਮਾਡਲ ਇਵਲੇਬਲ ਹੈਗੇ ਨੇ ਅਤੇ ਇੱਕ ਤਾਂ ਹੈਗਾ ਜੀ ਨੋਡ ਫਾਈਵ ਇੱਕ ਸੀ ਫੌਰ ਸੀ ਥਰੀ ਲਾਈਟ ਜੀ ਦੱਸੋ ਹਾਂਜੀ ਸੀ ਫੋਰ ਸਾਡੇ ਕੋਲ ਅਵੇਲੇਬਲ ਹੈਗਾ ਜੀ ਆਹ ਤੁਹਾਨੂੰ ਉਣੱਤੀ ਹਜ਼ਾਰ ਦਾ ਪਵੇਗਾ ਜੀ ਪੂਰੇ ਇਹਦੇ ਵਿੱਚ ਤੁਹਾ ਹਾਂਜੀ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਜੀ ਇੱਕ ਤਾਂ ਜੀ ਬਲੈਕ ਵੇਰੀਐਂਟ 'ਚ ਇੱਕ ਵਾਈਟ 'ਚ ਜੀ ਇੱਕ ਸਪੇਸ ਗ੍ਰੇਹ ਹੈਗਾ ਹੈ ਜੀ ਅਤੇ ਇੱਕ ਸੌ ਅਠਾਈ ਜੀ ਬੀ ਮਾਡਲ ਅਤੇ ਇੱਕ ਚੌਂਹਠ ਜੀ ਬੀ ਦੋਵੇਂ ਹੈਗੇ ਨੇ ਜੀ ਆਪਣੀ ਦੁਕਾਨ 'ਤੇ ਵੇ ਤੁਹਾਡੇ ਘਰ ਅਸੀਂ ਕੂਰੀਅਰ ਦੇ ਰਾਹੀਂ ਵੀ ਤੁਹਾਡੇ ਘਰ ਉਪਲੱਬਧ ਕਰਾ ਦਿਆਂਗੇ ਜੀ ਜਿੱਥੇ ਭਾਵੇਂ ਹੋਵੇ ਲੋਕਲ ਯਾਨੀ ਕਿ ਪੂਰੇ ਪੰਜਾਬ ਦੇ ਵਿੱਚ ਉਹਦੇ ਅਸੀਂ ਤੁਹਾਡੇ ਤੋਂ ਕਿਸੇ ਪ੍ਰਕਾਰ ਦਾ ਐਕਸਟਰਾ ਪੈਸਾ ਵੀ ਨਹੀਂ ਲਵਾਂਗੇ

ਹਾਂਜੀ ਜਿਹੜਾ ਚੌਂਹਠ ਜੀ ਬੀ ਵਾਲਾ ਹੈਗਾ ਜੀ ਉਹਦੇ ਵਿੱਚ ਚਾਰ ਜੀ ਬੀ ਰੈਮ ਹੋਵੇਗੀ ਅਤੇ ਉਹ ਤੁਹਾਨੂੰ ਅਸੀਂ ਜਿਹੜਾ ਦੂਜਾ ਹੈਗਾ ਜੀ ਪਹਿਲਾਂ ਅਸੀਂ ਅਠਾਈ ਇੱਕ ਸੌ ਅਠਾਈ ਜੀ ਬੀ ਦਾ ਰੇਟ ਦੱਸਿਆ ਸੀ ਜੀ ਉਣੱਤੀ ਹਜ਼ਾਰ ਦਾ ਅਤੇ ਇਹ ਜਿਹੜਾ ਚੌਂਹਠ ਜੀ ਬੀ ਹੈਗਾ ਤੁਹਾਨੂੰ ਮਾਤਰ ਛੱਬੀ ਹਜ਼ਾਰ ਦਾ ਪਵੇਗਾ ਜੀ ਹਾਂਜੀ ਅਤੇ ਇਸ ਤੋਂ ਇਲਾਵਾ ਇੱਕ ਆਵਰ ਹੋਰ ਵੀ ਹੈਗੀ ਹੈ ਜਿਹੜੀ ਜੇ ਤੁਸੀਂ ਲੈਣੇ ਚਾਹੋਗੇ ਜੇ ਤੁਸੀਂ ਆਹ ਵਾਲਾ ਫੋਨ ਲੈਂਦੇ ਹੋ ਤਾਂ ਇੱਕ ਈਅਰਬਡ ਚੱਲਦੇ ਪਏ ਅੱਜ ਕੱਲ੍ਹ ਲਾਈਟ ਵਨ ਈਅਰਬਡ ਉਹ ਤੁਹਾਨੂੰ ਮਾਤਰ ਪੰਦਰਾਂ ਸੌ ਐਕਸਟਰਾ ਪੇਅ ਕਰਕੇ ਤੁਹਾਨੂੰ ਜਿਹੜੇ ਚਾਰ ਹਜ਼ਾਰ ਦੇ ਆ ਉਹ ਵੀ ਇਹਦੇ ਨਾਲ ਆਫਰ ਚੱਲਦੀ ਪਈ ਅੱਜ ਦੇ ਦਿਨ ਉਹ ਵੀ ਮਿਲ ਜਾਣਗੇ ਪਰ ਉਹਦੇ ਲਈ ਤੁਹਾਡੇ ਕੋਲ ਐਕਸਿਸ ਬੈਂਕ ਦਾ ਕਰੈਡਿਟ ਕਾਰਡ ਹੋਣਾ ਚਾਹੀਦਾ ਹੈ ਜੀ ਡਿਸਕਾਊਂਟ ਜੀ ਮੈਕਸੀਮਮ ਡਿਸਕਾਊਂਟ ਕਰ ਤਾ ਜੀ ਇਸ ਤੋਂ ਵੱਧ ਡਿਸਕਾਊਂਟ ਜਿਹੜਾ ਹੈਗਾ ਉਹ ਤੁਹਾਨੂੰ ਦੱਸ ਤਾ ਜੀ ਕ੍ਰੈਡਿਟ ਕਾਰਡ 'ਤੇ ਹੈਗਾ ਹੈ ਉਹ ਤੁਸੀਂ ਲੈ ਸਕਦੇ ਹੋ ਯਾਨੀ ਕਿ ਜਿਹੜਾ ਤੁਹਾਨੂੰ ਚਾਰ ਹਜ਼ਾਰ ਦੇ ਜਿਹੜੇ ਈਅਰਫੋਨ ਈਅਰਬਡ ਹੈਗੇ ਆ ਉਹ ਤੁਹਾਨੂੰ ਮਾਤਰ ਪੰਦਰਾਂ ਸੌ ਦੇ ਪੈ ਜਾਣਗੇ ਉਹ ਸਵੇਰੇ ਸਵੇਰੇ ਦਸ ਵਜੇ ਤੋਂ ਲੈ ਕੇ ਸ਼ਾਮ ਨੂੰ ਛੇ ਵਜੇ ਤੱਕ ਦੁਕਾਨ 'ਤੇ ਜਦੋਂ ਮਰਜ਼ੀ ਆ ਜਾਓ ਕਿਉਂਕਿ ਉਹਦੇ ਚੌਂਹਠ ਜੀ ਬੀ ਦੇ ਵਿੱਚ ਦੋ ਕਲਰ ਆਪਸ਼ਨ ਹੀ ਅਵੇਲੇਬਲ ਹੈਗੀਆਂ ਨੇ ਉਹ ਤੁਸੀਂ ਵੇਖ ਲਿਆ ਜੇ ਜਿਹੜਾ ਤੁਹਾਨੂੰ ਪਸੰਦ ਆਵੇ ਜੀ ਉਹ ਮਾਡਲ ਅਸੀਂ ਤੁਹਾਨੂੰ ਦੇ ਦੇਵਾਂਗੇ ਅਤੇ ਹੋਰ ਕੋਈ ਗੱਲ ਨਹੀਂ ਪੰਜ ਸੌ ਹਜ਼ਾਰ ਰੁਪਏ ਦਾ ਡਿਸਕਾਊਂਟ ਹੋਰ ਹੋਵੇਗਾ ਤਾਂ ਉਹਦੀ ਤੁਹਾਡੇ ਲਈ ਅਸੀਂ ਕਰਵਾ ਦੇਵਾਂਗੇ ਜੀ ਹਾਂਜੀ ਉਹ ਵੀ ਹੋ ਜੂ